ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਅੱਛਾ ਕਦੋਂ ਹੈ ਮੈਡਮ ਤੁਹਾਡਾ ਵਿਆਹ ਅੱਛਾ ਅੱਛਾ ਅੱਛਾ ਅਤੇ ਓਕੇ ਕੋਈ ਨਹੀਂ ਮੈਡਮ ਆਪਾਂ ਫਰੀ ਜਿਹੇ ਹਾਂ ਤੁਸੀਂ ਦੱਸੋ ਪੂਰਾ ਪੂਰਾ ਵਧੀਆ ਬੰਦੋਬਸਤ ਕਰ ਦਾਂਗੇ ਸਾਡਾ ਨਾਮ ਤੁਸੀਂ ਸੁਣਿਆ ਹੀ ਹੋਣਾ ਅਸੀਂ ਬਹੁਤ ਵਧੀਆ ਇਵੈਂਟ ਪਲੈਨਅਰ ਕਰਦੇ ਹਾਂ ਤੇ ਅਤੁਸੀਂ ਦੱਸੋ ਕਿਵੇਂ ਦਾ ਵਿਆਹ ਚਾਹੁੰਦੇ ਹੋ ਤੁਸੀਂ ਕੋਈ ਨਹੀਂ ਕੋਈ ਨਹੀਂ ਮੈਡਮ ਆਪਾਂ ਬਹਿ ਕੇ ਕਰ ਲਾਂਗੇ ਪੈਸਿਆਂ ਦੀ ਗੱਲ ਤੁਸੀਂ ਰੋਇਲ ਕਿਹਾ ਨਾ ਰੋਇਲ ਤੁਹਾਨੂੰ ਤਾਂ ਪੂਰੀ ਮਹਾਰਾਜਾ ਮਹਾਰਾਣੀ ਵਰਗੀ ਫੀਲ ਦੇਵਾਂਗੇ ਅਤੇ ਜਿਹੜੇ ਸਰ ਨੇ ਜਿਹੜਾ ਤੁਹਾਡੇ ਹਸਬੈਂਡ ਉਹਨਾਂ ਨੂੰ ਆਪਾਂ ਰੱਥ 'ਤੇ ਹ ਕਰ ਲਾਂਗੇ ਉਹ ਰੱਥ 'ਤੇ ਆਉਣਗੇ ਅਤੇ ਤੁਹਾਨੂੰ ਵੀ ਹੈ ਪੂਰੀ ਐਂਟਰੀ ਤੁਹਾਡੀ ਵਧੀਆ ਕਰਾਵਾਂਗੇ ਇਹ ਫਲਾਵਰ ਡੈਕੋਰੇਸ਼ਨ ਦੇ ਨਾਲ ਅੱਗੇ ਡਾਂਸਰਜ਼ ਡਾਂਸ ਕਰ ਰਹੀਆਂ ਹੋਣਗੀਆਂ ਤੁਸੀਂ ਦੱਸੋ ਕਿਹੋ ਜਿਹੇ ਫੁੱਲ ਪਸੰਦ ਨੇ ਤੁਹਾਨੂੰ ਇਹੋ ਜਿਹੀ ਡੈਕੋਰੇਸ਼ਨ ਪਸੰਦ ਹੈ ਕੋਈ ਨਹੀਂ ਮੈਡਮ ਲਿੱਲੀ ਸਭ ਵਧੀਆ ਤੋਂ ਵਧੀਆ ਫੁੱਲ ਲਾ ਦਾਂਗੇ ਅੱਜ ਕੱਲ੍ਹ ਦੀ ਮੋਡਰਨ ਡੈਕੋਰੇਸ਼ਨ ਕਰਾਂਗੇ ਵਧੀਆ ਤੋਂ ਵਧੀਆ ਅਤੇ ਬਾਕੀ ਮੈਮ ਕੋਈ ਨਹੀਂ ਆਪਾਂ ਬਹਿ ਕੇ ਗੱਲ ਕਰਾਂਗੇ ਇੱਕ ਵਾਰੀ ਤੁਸੀਂ ਵਧੇਰੇ ਜਾਣਕਾਰੀ ਲਈ ਮੇਰੇ ਦਫ਼ਤਰ ਵਿਜਿਟ ਕਰ ਲਉ ਓਕੇ ਮੈਡਮ ਸਤਿ ਸ਼੍ਰੀ ਅਕਾਲ